ਹਾਂਜੀ ਬਿਲਕੁਲ ਸਾਡੇ ਪਿੰਡ ਵਿੱਚ ਖ਼ਾਸ ਤੌਰ 'ਤੇ ਤਿਉਹਾਰ ਜਾਂ ਸਮਾਗਮ ਹੁੰਦੇ ਹਨ ਜਿਨ੍ਹਾਂ ਵਿੱਚ ਡਾਂਸ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਵੇਂ ਕਿ ਦੇਖਿਆ ਜਾਵੇ ਕਿ ਵਿਸਾਖੀ ਦੇ ਮਹੀਨੇ ਵਿੱਚ ਕਣਕ ਪੱਕਣ ਦੀ ਖੁਸ਼ੀ ਵਿੱਚ ਕਿਸਾਨਾਂ ਵੱਲੋਂ ਭੰਗੜਾ ਜਾਂ ਕਹਿ ਲਓ ਡਾਂਸ ਕੀਤਾ ਜਾਂਦਾ ਹੈ ਅਤੇ ਸਾਉਣ ਕੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਵਿੱਚ ਇਸਤਰੀਆਂ ਦੁਆਰਾ ਡਾਂਸ ਕੀਤਾ ਜਾਂਦਾ ਹੈ ਸਾਡੇ ਪਿੰਡ ਵਿੱਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ ਜੋ ਕਿ ਸਾਉਣ ਦੇ ਮਹੀਨੇ ਵਿੱਚ ਸਪੈਸ਼ਲ ਕੁੜੀਆਂ ਲਈ ਹੀ ਹੁੰਦਾ ਹੈ ਕੁੜੀਆਂ ਆਪਣੇ ਮਨ ਪਸੰਦ ਅਨੁਸਾਰ ਗਾਣੇ ਗਾ ਕੇ ਜਾਂ ਫਿਰ ਡੀ ਜੇ ਉੱਪਰ ਗਾਣੇ ਲਗਾ ਕੇ ਡਾਂਸ ਕਰਦੀਆਂ ਹਨ ਕੋਈ ਵੀ ਤਿਉਹਾਰ ਜਾਂ ਮੌਕਾ ਇਹੋ ਜਾ ਨਹੀਂ ਹੁੰਦਾ ਖੁਸ਼ੀ ਵਾਲਾ ਜਿਸ ਵਿੱਚ ਅਸੀਂ ਖੁਸ਼ ਹੋ ਕੇ ਨੱਚਣ ਨਹੀਂ ਲੱਗ ਜਾਂਦੇ ਵਿਆਹ ਸ਼ਾਦੀਆਂ ਵਿਚ ਵੀ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਜਦੋਂ ਤੋਂ ਅਸੀਂ ਡਾਂਸ ਕਰਨ ਲੱਗ ਜਾਂਦੇ ਹਾਂ ਜਾਂ ਸਾਡੇ ਪਰਿਵਾਰ ਵਿੱਚ ਜਦੋਂ ਕੋਈ ਨਵਾਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦਾ ਤੇਰਵਾਂ ਜਾਂ ਇੱਕੀਵਾਂ ਕੀਤਾ ਜਾਂਦਾ ਹੈ ਜਾਂ ਜਦੋਂ ਬੱਚਾ ਸਵਾ ਮਹੀਨੇ ਦਾ ਹੋ ਜਾਂਦਾ ਹੈ ਤਾਂ ਉਦੋਂ ਵੀ ਉਸ ਦਾ ਇੱਕ ਪ੍ਰੋਗਰਾਮ ਆਯੋਜਿਤ ਕਰਕੇ ਅਸੀਂ ਉਸ ਵਿੱਚ ਖੁਸ਼ ਹੋ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਾਂ ਸਾਡੇ ਪਿੰਡ ਵਿੱਚ ਵੈਸੇ ਤਾਂ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਸ ਵਿੱਚ ਅਸੀਂ ਨੱਚਦੇ ਹਾਂ ਪਰ ਕਣਕ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਵਿੱਚ ਅਤੇ ਸਾਉਣ ਦੇ ਮਹੀਨੇ ਵਿੱਚ ਤੀਆਂ ਵਿੱਚ ਇੱਕ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਸ ਵਿੱਚ ਡਾਂਸ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਾਂ ਕਹਿ ਸਕਦੇ ਹਾਂ ਕਿ ਅਸੀਂ ਖੁਸ਼ੀ ਦੇ ਮੌਕੇ ਵਿੱਚ ਡਾਂਸ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ